ਬਿਲਕੁਲ ਜੀ ਮੈਂ ਦੌੜਦੇ ਸਮੇਂ ਇੱਕ ਵਾਰ ਪੈਰ ਫਿਸਲਣ ਕਾਰਨ ਡਿੱਗ ਗਿਆ ਸੀ ਜਿਸ ਜਿਸ ਤੋਂ ਬਾਅਦ ਮੈਂ ਦੋ ਦਿਨ ਦੌੜ ਨਹੀਂ ਲਗਾ ਸਕਿਆ ਅਤੇ ਉਸ ਨੂੰ ਮੈਂ ਆਪਣਾ ਡੋਕਟਰ ਦੀ ਸਲਾਹ ਨਾਲ ਬੀਟਾਡੀਨ ਵਗੈਰਾ ਅਤੇ ਹੋਰ ਛੋਟਾ ਇਲਾਜ ਦੌਰਾਨ ਦੋ ਦਿਨ ਦੀ ਰੈਸਟ ਤੋਂ ਬਾਅਦ ਦੁਬਾਰਾ ਦੌੜ 'ਤੇ ਆ ਸਕਿਆ